ਖੇਡਾਂ ਦੇ ਪੱਧਰ 'ਚ ਵੀ ਜਿਹੜੇ ਅੱਜ ਕੱਲ੍ਹ ਦੇ ਸਾਡੇ ਬੱਚੇ ਆ ਵੀ ਜ਼ਿਆਦਾਤਰ ਸਾਡੇ ਆਮ ਪਿੰਡਾਂ ਦੇ ਵਿੱਚ ਤਾਂ ਵੀ ਗਰਾਊਂਡ ਸਟੇਡੀਅਮ ਬਣੇ ਹੋਏ ਆ ਇਸ ਵਿੱਚ ਜਿਹੜੇ ਬੱਚੇ ਆ ਉਹ ਕ੍ਰਿਕਟ ਦੇ ਮੈਚ ਖੇਡਦੇ ਆ ਅਤੇ ਜਿਵੇਂ ਕਿ ਸਾਡੇ ਤਾਂ ਗਰਾਊਂਡਾਂ ਤੋਂ ਇਲਾਵਾ ਖੇਤਾਂ ਦੇ ਵਿੱਚ ਵਾਹੁਣ ਖੇਤ ਕਹਿ ਦਿੰਦੇ ਹਾਂ ਜਿਹਨੂੰ ਆਪਾਂ ਜਿੰਨਾ ਟਾਈਮ ਉੱਥੇ ਵੀ ਝੋਨਾ ਲਾਇਆ ਨਹੀਂ ਜਾਂਦਾ ਉੰਨਾ ਟਾਈਮ ਉੱਥੇ ਬੱਚੇ ਲੱਲਾ ਗੁੱਚੀ ਖੇਡਦੇ ਆ ਜ਼ਿਆਦਾਤਰ ਗਰਾਊਂਡਾਂ ਦੇ ਵਿੱਚ ਲੋਕ ਕ੍ਰਿਕਟ ਖੇਡਦੇ ਆ ਗਰਾਊਂਡਾਂ ਦੇ ਵਿੱਚ ਹੀ ਅਲੱਗ ਅਲੱਗ ਖੇਡਾਂ ਦੇ ਕੋਟ ਬਣੇ ਆ ਜਿਵੇਂ ਕਿ ਬਾਸਕਿਟਬੋਲ ਦਾ ਅਤੇ ਹੈਂਡਬੋਲ ਦਾ ਤਾਂ ਉੱਥੇ ਜਿਹੜੇ ਬੱਚੇ ਆ ਉਹ ਬਾਸਕਿਟਬੋਲ ਅਤੇ ਹੈਂਡਬਾਲ ਖੇਡਦੇ ਆ ਇਸ ਤੋਂ ਇਲਾਵਾ ਕਈ ਛੋਟੇ ਛੋਟੇ ਜਿਹੜੇ ਬੱਚੇ ਹੁੰਦੇ ਆ ਉਹ ਦਾਈ ਦੁੱਕੜਾ ਫੜਨ ਫੜੀਚੀ ਬਿਜਲੀ ਕਰੰਟ ਖੇਡਦੇ ਰਹਿੰਦੇ ਆ ਗਰਾਉਂਡਾਂ ਦੇ ਵਿੱਚ ਉਹ ਵੀ ਨਵੀਆਂ ਖੇਡਾਂ ਦੇ ਵਿੱਚ ਤਾਂ ਕ੍ਰਿਕਟ ਬਾਸਕਿਟਬੋਲ ਅਤੇ ਉੱਥੇ ਕਈ ਬੱਚੇ ਬੈਡਮਿੰਟਨ ਵੀ ਆਪਣਾ ਲੈ ਕੇ ਜਾਂਦੇ ਆ ਅਤੇ ਬੈਡਮਿੰਟਨ ਵੀ ਬੈਡਮਿੰਟਨ ਥਰੋਅ ਖੇਡਦੇ ਆ ਇਹ ਨਵੀਆਂ ਖੇਡਾਂ ਦੇ ਵਿੱਚ ਬੱਚੇ ਖੇਡਦੇ ਆ